ਹੈਲੋ ਸਤਿ ਸ਼੍ਰੀ ਅਕਾਲ ਹੈਲੋ ਸਤਿ ਸ਼੍ਰੀ ਅਕਾਲ ਮੈਡਮ ਹਾਂਜੀ ਵੋਲਵੋ ਬੱਸ ਏਜੇਂਸੀ ਤੋਂ ਬੋਲਦੇ ਹੋ ਮੈਂ ਹਰਿਆਣੇ ਤੋਂ ਇੱਥੇ ਘੁੰਮਣ ਆਈ ਹਾਂ ਅਤੇ ਬੱਸ ਮਿਲ ਜਾਏਗੀ ਤੁਹਾਡੀ ਇੱਥੋਂ ਅੱਛਾ ਅਤੇ ਮੈਂ ਤਰਨ ਤਾਰਨ ਘੁੰਮਣਾ ਵਾ ਅੱਛਾ ਓਕੇ ਮੈਮ ਹਾਂਜੀ ਮੈਂ ਬਸ ਠੀਕ ਹੈ ਮੈਮ

ਹਾਂਜੀ ਮੈਂ ਵਾਪਿਸ ਵੀ ਜਾਣਾ ਓਕੇ ਓਕੇ ਮੈਮ ਓਕੇ ਮੈਮ